ਮੈਂ ਖਾਣਾ ਬਣਾਉਣ ਤੋਂ ਪਹਿਲਾਂ ਇੱਕ ਵਧੀਆ ਤਰੀਕੇ ਨਾਲ ਸਬਜ਼ੀਆਂ ਨੂੰ ਕੱਟ ਕੇ ਉਹ ਕੱਟਣ ਤੋਂ ਪਹਿਲਾਂ ਵੀ ਉਸ ਚੀਜ਼ ਨੂੰ ਧੋ ਕੇ ਗਰਮ ਪਾਣੀ ਨਾਲ ਧੋ ਕੇ ਕਈ ਚੀਜ਼ਾਂ ਨੂੰ ਸਾਨੂੰ ਗਰਮ ਪਾਣੀ ਨਾਲ ਧੋਣਾ ਪੈਂਦਾ ਕਿਸੇ ਚੀਜ਼ ਨੂੰ ਆਪਾਂ ਫਰੈਸ਼ ਪਾਣੀ ਨਾਲ ਧੋ ਦਿੰਦੇ ਹਾਂ ਜਿਹਦੇ ਨਾਲ ਕਿ ਸਾਨੂੰ ਉਸ ਚੀਜ਼ ਨੂੰ ਕ ਕਿਸੇ ਚੀਜ਼ ਨੂੰ ਸਾਨੂੰ ਕੱਟਣ 'ਚ ਆਸਾਨੀ ਹੁੰਦੀ ਹੈ ਜਿੱਦਾਂ ਕੀ ਗੋਭੀ ਵਰਗੀਆਂ ਸਾਡੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਸਾਨੂੰ ਗਰਮ ਪਾਣੀ 'ਚ ਧੋ ਕੇ ਰੱਖਣੀਆਂ ਪੈਂਦੀਆਂ ਜਿਹਦੇ ਨਾਲ ਕਿ ਉਹਦੇ ਵਿੱਚੋਂ ਕਿਟਾਣੂ ਮਰ ਜਾਣ ਅਤੇ ਸਾਨੂੰ ਉਸ ਚੀਜ਼ ਨੂੰ ਕੱਟ ਕੇ ਪ੍ਰੋਪਰ ਢੰਗ ਨਾਲ ਆਪਾਂ ਉਸ ਚੀਜ਼ ਨੂੰ ਤੜਕੇ ਦੀਆਂ ਸਾਰੀਆਂ ਚੀਜ਼ਾਂ ਦੀ ਉਹ ਉਹ ਕਰਦੇ ਹਾਂ ਤਿਆਰੀ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਪਿਆਜ਼ ਅਦਰਕ ਲਸਣ ਵਗੈਰਾ ਵਰਗੀਆਂ ਚੀਜ਼ਾਂ ਨੂੰ ਕੱਟ ਕੇ ਪਹਿਲਾਂ ਰੱਖਣਾ ਪੈਂਦਾ ਵਿੱਚ ਮਸਾਲੇ ਤੇਲ ਵਗੈਰਾ ਦੀ ਦੇਖਣੀ ਪੈਂਦੀ ਕਿਹੜੇ ਤੇਲ ਦੀ ਆਪਾਂ ਵਰਤੋਂ ਕਰਾਂਗੇ ਕਿਹੜੇ ਕਿਸ ਚੀਜ਼ ਨਾਲ ਸਾਡੇ ਖਾਣੇ ਦੇ ਵਿੱਚ ਸਵਾਦ ਆਏਗਾ ਕਿਸ ਚੀਜ਼ ਨਾਲ ਸਾ ਸਾਰਿਆਂ ਨੂੰ ਉਸ ਚੀਜ਼ ਦੀ ਪਸੰਦ ਉਸ ਚੀਜ਼ ਨੂੰ ਪਸੰਦ ਉਸ ਚੀਜ਼ ਨੂੰ ਪਸੰਦ ਆਉਣੀ ਚਾਹੀਦੀ ਆ ਕਿਸ ਢੰਗ ਨਾਲ ਸਾਡੇ ਨਮਕ ਘੱਟ ਵੱਧ ਨਾ ਹੋ ਜੇ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਸਾਨੂੰ ਕੁ ਖਾਣਾ ਬਣਾਉਣਾ ਪੈਂਦਾ ਹੈ ਹਰ ਇੱਕ ਤਰੀਕੇ ਦੀ ਅਵੇਲੇਬਿਲਟੀ ਸਾਨੂੰ ਦੇਖਣੀ ਪੈਂਦੀ ਹੈ ਕਿਸ ਤਰੀਕੇ ਨਾਲ ਆਪਾਂ ਉਸ ਚੀਜ਼ ਨੂੰ ਖਾਣੇ ਨੂੰ ਬਣਾ ਸਕਦੇ ਹਾਂ